ਮੈਂ ਔਨਲਾਈਨ ਟੀ ਸ਼ਟਸਸ ਟੀ ਸ਼ਰਟਾਂ ਮੰਗਵਾਈਆਂ ਸੀ ਮੇਰਾ ਪੋਜਟਿਵ ਰੀਵਿਊ ਇਹ ਹੈ ਕਿ ਮਤਲਬ ਔਨਲਾਈਨ ਚੀਜ਼ ਅੱਵਲ ਤਾਂ ਸਹੀ ਨਹੀਂ ਆਉਂਦੀ ਹੈ ਬੱਟ ਇਹ ਟੀ ਸ਼ਰਟਾਂ ਜਿਹੜੀਆਂ ਮੈਂ ਮੰਗਵਾਈਆਂ ਬਹੁਤ ਵਧੀਆ ਆਈਆਂ ਇਨ੍ਹਾਂ ਦੀ ਫੀਟਿੰਗ ਬਹੁਤ ਪ੍ਰੋਪਰ ਹੈ ਕਲਰ ਬਹੁਤ ਅੱਛੇ ਹਨ ਮੈਂ ਜਿਸ ਵੀ ਬੰਦੇ ਨੇ ਮੇਰੀਆਂ ਇਹ ਸ਼ਰਟਾਂ ਦੇਖੀਆਂ ਟੀ ਸ਼ਰਟਾਂ ਦੇਖੀਆਂ ਬਹੁਤ ਵਧੀਆ ਲੱਗੀਆਂ ਇਹਦੇ ਕਲਰ ਜਦੋਂ ਮੈਂ ਪਾਏ ਤਾਂ ਡਿਫਰੈਂਟ ਕਲਰ ਸੀ ਅਤੇ ਮੇਰੇ ਜਿਸ ਦੋਸਤ ਨੇ ਜਾਂ ਫੈਮਿਲੀ ਮੈਂਬਰਸ ਨੇ ਮਤਲਬ ਟੀ ਸ਼ਰਟਾਂ ਮੰਗਵਾਈਆਂ ਉਨ੍ਹਾਂ ਨੇ ਮਤਲਬ ਸਿਫ਼ਤ ਕੀਤੀ ਹੈ ਉਨ੍ਹਾਂ ਨੇ ਆਪਣੇ ਲਈ ਵੀ ਔਡਰ ਕਰਨ ਲਈ ਮੈਨੂੰ ਕਿਹਾ ਹੈ ਕਿ ਸਾਡੇ ਲਈ ਵੀ ਮੰਗਵਾ ਦੇ ਅਤੇ ਇਸ ਦੀ ਖਾਸੀਅਤ ਇਹ ਹੈ ਕਿ ਇਸਦਾ ਪ੍ਰੋਪਰ ਸਾਈਜ਼ ਜਿਹੜਾ ਕਿ ਪੁਰ ਪੂਰਾ ਫੀਟਿੰਗ 'ਚ ਹੈ ਅਤੇ ਨਾਲ ਹੀ ਨਾਲ ਆਪਣੇ ਫੈਮਿਲੀ ਮੈਂਬਰਸ ਲਈ ਵੀ ਮੈਂ ਔਡਰ ਕੀਤੀਆਂ ਹੋਈਆਂ ਹਨ ਟੀ ਸ਼ਰਟਸ ਮਤਲਬ ਔਨਲਾਈਨ ਅੱਵਲ ਚੀਜ਼ ਵਧੀਆ ਨਹੀਂ ਆਉਂਦੀ ਹੈ ਬੱਟ ਮੈਨੂੰ ਬਹੁਤ ਵਧੀਆ ਲੱਗੀ ਹੈ ਅਤੇ ਮੈਂ ਆਪਣੇ ਫੈਮਿਲੀ ਮੈਂਬਰਸ ਜਾਂ ਫਰੈਂਡਸ ਲਈ ਵੀ ਔਡਰ ਕੀਤੀ ਹੋਈ ਹੈ